ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਸਰਕਾਰ ਤੋਂ ਇਹ ਮੰਗ ਕਰਦਾ ਇਹ ਸੜਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈਗਾ ਜਿਵੇਂ ਜਦੋਂ ਅਸੀਂ ਤਪੇ ਤੋਂ ਬਰਨਾਲਾ ਰੋਡ ਚੜ੍ਹਦੇ ਹਾਂ ਅਤੇ ਉਹ ਜਿਹੜਾ ਰਾਈਟ ਹੈਡ ਨਾ ਮਹਿਤਾ ਪਿੰਡ ਹੈਗਾ ਉਸ ਨੂੰ ਜਿਹੜੀ ਸੜਕ ਜਾਂਦੀ ਨਾ ਇੰਨੀ ਘਟੀਆ ਸੜਕ ਹੈ ਇੰਨੀ ਘਟੀਆ ਸੜਕ ਆ ਮੈਂ ਦੱਸ ਨਹੀਂ ਸਕਦਾ ਮੇਰੀ ਗੱਡੀ ਦਾ ਐਕਸਲ ਘੱਟੋ ਘੱਟ ਦਸ ਵਾਰੀ ਟੁੱਟ ਗਿਆ ਕਿਉਂਕਿ ਉੱਥੇ ਸਾਨੂੰ ਜਾਣਾ ਪੈਂਦਾ ਹੈਗਾ ਸਕੂਲ ਦੇ ਵਿੱਚ ਜਾਂਦੇ ਹਾਂ ਜਾਂ ਕੋਈ ਵੀ ਬੱਚਿਆ ਨੂੰ ਛੱਡਣ ਜਾਂਦੇ ਹੈਗੇ ਤਾਂ ਬੱਚੇ ਪੜ੍ਹਦੇ ਨਹੀਂ ਉੱਥੇ ਸਕੂਲ ਦੇ ਵਿੱਚ ਤਾਂ ਉਹ ਜਿਹੜਾ ਕੀ ਹੈਗਾ ਦਸ ਵਾਰੀ ਐਕਸਲ ਟੁੱਟ ਗਿਆ ਮੇਰਾ ਐਡੀ ਘਟੀਆ ਸੜਕ ਆ ਜੀ ਜੇ ਕਿਸੇ ਨੂੰ ਐਮਰਜੰਸੀ ਬਰਨਾਲਾ ਹੋਸਪਿਟਲ ਜਾਣਾ ਹੋਵੇ ਜਾਂ ਤਪਾ ਜਾਣਾ ਹੋਵੇ ਉਹ ਸੜਕ ਕਿੱਥੋਂ ਜਾ ਸਕੇਗਾ ਅਗਲਾ ਇੰਨਾ ਬਹੁਤ ਜ਼ਿਆਦਾ ਮੈਨੂੰ ਜਿਹੜੇ ਆ ਇਹ ਸੜਕਾਂ ਦੇ ਬਾਰੇ ਹੀ ਮੈਂ ਕਹਿਣਾ ਚਾਹੁੰਦਾ ਹੈਗਾ ਵੀ ਜਿਹੜੀ ਪੰਜਾਬ ਸਰਕਾਰ ਆ ਸੜਕਾਂ ਦੇ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਉਹਨੂੰ ਅਤੇ ਸਿਹਤ ਸੰਭਾਲ ਤਾਂ ਜਿਹੜਾ ਪਿੰਡਾਂ ਦੇ ਤੁਹਾਨੂੰ ਪਤਾ ਹੀ ਹੈ ਨਹੀਂ ਤਾਂ ਹੁੰਦੀ ਨਹੀਂ ਹਰ ਇੱਕ ਨੂੰ ਵੱਡੇ ਸ਼ਹਿਰ 'ਚ ਜਾਣਾ ਪੈਂਦਾ ਹੈਗਾ ਜਿੱਥੋਂ ਖੋਲ੍ਹੇ ਵੀ ਸੀਗੇ ਆਪਣੇ ਜਿਹੜੇ ਸਿਹਤ ਕੇਂਦਰ ਜਿਹੇ ਬਣਾਏ ਸੀ ਉਹਨਾਂ ਨੇ ਉਹਨਾਂ ਦਾ ਵੀ ਕੋਈ ਜ਼ਿਆਦਾ ਵਧੀਆ ਰੋਲ ਨਹੀਂ ਹੈਗਾ ਹੈਗਾ ਅਤੇ ਇਸ ਲਈ ਸਰਕਾਰ ਨੂੰ ਚਾਹੀਦਾ ਹੈਗਾ ਚਾਹੀਦਾ ਦੇਖੋ ਵਾਧੂ ਹੈਗੀ ਹੈਗੀ ਆ ਸਿੱਖਿਆ ਦੇ ਸੀਸ ਸੰਭਾਲ ਦੇ ਉੱਪਰ ਧਿਆਨ ਦੇਣਾ ਚਾਹੀਦਾ ਪਰ ਮੇਰੇ ਅਨੁਸਾਰ ਤਾਂ ਜਿਹੜੀ ਸੜਕਾਂ ਦੀ ਹਾਲਤ ਵਧੀਆ ਹੋਣੀ ਚਾਹੀਦੀ ਹੈ